ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਬਸ ਤੁਸੀਂ ਸੁਣਾਓ ਹਾਂਜੀ ਘਰੇ ਸਾਰੇ ਠੀਕ ਐ ਜੀ ਦੱਸੋ ਹਾਂ ਕੀ ਕਰਦੇ ਆ ਨਿਕਲ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਕਿਹੜੀ ਕਿੰਨਾ ਚਾਹੁੰਦੇ ਫੁੱਲ ਟਾਈਮ ਕਰਨਾ ਚਾਹੁੰਦੇ ਫੁੱਲ ਟਾਈਮ ਕਰਨਾ ਚਾਹੁੰਦੇ ਜੀ ਸੋ ਤੁਸੀਂ ਆਪਣਾ ਐਕਸਕਲੂਸਿਵ ਚਲਾਣ ਦਾ ਹੁੰਦਾ ਜੀ ਹੁਣ ਤੁਹਾਨੂੰ ਪਤਾ ਹੀ ਆਮ ਹੋ ਗਿਆ ਵਾ ਹਾਂਜੀ ਫਿਰ ਹੋਸਪਿਟਲ ਵੱਲ ਇੱਕ ਨਿਕਲੀ ਵੈਕੈਂਸੀ ਨਾ ਡਿਊਡੀ ਕਰਨਾ ਚਾਹੁੰਦੇ ਹੋ ਦੱਸੋ ਹਾਂਜੀ ਬਸ ਖੁਸ਼ੀ ਦਾ ਡਾਟਾ ਐਂਟਰੀ ਕਰਨਾ ਤੁਹਾਨੂੰ ਐਕਸਲ਼ ਦਾ ਵਰਕ ਆਉਣਾ ਚਾਹੀਦਾ ਤੁਹਾਨੂੰ ਇੱਕ ਵਧੀਆ ਆਉਂਦਾ ਤੁਸੀਂ ਉੱਪਰ ਐਂਟਰੀਆਂ ਚਰਾਣੀ ਪੇਸ਼ਂਟ ਦੀਆਂ ਹਾਂਜੀ ਹਾਂਜੀ ਤੁਸੀਂ ਰਿਕਾਰਡ ਵਗੈਰਾ ਸੈਲਰੀ ਵਾਲਾ ਰੱਖਣਾ ਹੀ ਐ ਡਾਟਾ ਐਂਟਰੀ ਦਾ ਕੰਮ ਹੈ ਹਾਂਜੀ ਹਾਂਜੀ ਦੇਖੋ ਜੀ ਜੇ ਤੁਹਾਡੇ ਕੋਲ ਥੋੜਾ ਐਕਸਪੀਰੀਅੰਸ ਪੂਰੰਸ ਹੈਗਾ ਅਠਾਰਾਂ ਕ ਹਜ਼ਾਰ ਥੋਡਾ ਬਣੀ ਜਾਣਾ ਜੇ ਤੁਸੀਂ ਫੁੱਲ ਟਾਈਮ 'ਚ ਕਰਨਾ ਚਾਹੁੰਦੇ ਆ ਜੇ ਪਾਰਟ ਟਾਈਮ 'ਚ ਕਰਨਾ ਤੁਹਾਨੂੰ ਫਿਰ ਉਹਨੂੰ ਬਾਰਾਂ ਹਜ਼ਾਰ ਥੋਨੂੰ ਉਹਨਾਂ ਨੇ ਦੇ ਦੇਣਾ ਹਾਂਜੀ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਵਧੀਆ ਤੁਹਾਨੂੰ ਆਸਾਨ ਨਹੀਂ ਵੀ ਆਉਣੀ ਲੈਣੀ ਨੂੰ ਹਾਂਜੀ ਪੈਸੇ ਤਾਂ ਦੇਖੋ ਜੀ ਸਟਾਰਟਿੰਗ 'ਚ ਕੋਈ ਵੀ ਤੁਸੀਂ ਜਦੋਂ ਕੋਈ ਮਿਲਣੀ ਤਾਂ ਇਹੀ ਬੰਦਾ ਸਾਢੇ ਅਠਾਰਾਂ ਦਾ ਬਾਕੀ ਤਾਂ ਹੌਲੀ ਹੌਲੀ ਟਾਈਮ ਲੱਗਦਾ ਠੀਕ ਐ ਜੀ ਤੇ ਇੱਕ ਅਕਾਊਂਟਡ ਦੀ ਹੈ ਪਰ ਊਜਲੀ ਐਕਸਪੀਰੀਅੰਸ ਮੰਗਿਆ ਵਾ ਦੋ ਸਾਲ ਦਾ ਪਰ ਉਹਦੀ ਸਟਾਰਟਿੰਗ ਪੱਚੀ ਹਜ਼ਾਰ ਤੇ ਜੀ ਤੇ ਹਾਂ ਹਾਂਜੀ ਹਾਂਜੀ ਅਗਰ ਪਿਆ ਤਾ ਕੋਈ ਚੱਕਰ ਨਹੀਂ ਐਕਸਪੀਰੀਅੰਸ ਹੁੰਦਾ ਜੀ ਉਹਦਾ ਬਾਕੀ ਤੁਸੀਂ ਥੋੜਾ ਇੰਟਰਵਿਊ ਆਪਣਾ ਬੇਸਕ ਇੰਟਰਵਿਊ ਕਲੀਅਰ ਕਰ ਲਿਓ ਤੇ ਤੁਹਾਨੂੰ ਜਿਹੜੀ ਬੇਸ 'ਤੇ ਅਕੋਰਡਿੰਗ ਤੁਹਾਨੂੰ ਮਿਲ ਜਾਣੀ ਐ ਜੀ ਹਾਂਜੀ ਬਈ ਦੂਸਰਾ ਬੱਸ ਅੱਡੇ 'ਤੇ ਬਸ ਬੱਤੀ ਨੰਬਰ ਗਲੀ ਨੰਬਰ 'ਚ ਹੈ ਜੀ ਉਹ ਹਾਂ ਕਨੋਲੀ ਅਕਾਊਂਟਡ ਹੈ ਜੀ ਕਨੋਲੀ ਸੀ ਏ ਐ ਜੀ ਊਹ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਕੋਈ ਉਹ ਨਹੀਂ ਐ ਬਿਲਕੁਲ ਆਪਣੀ ਨਾਈਟਸ ਵੀ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ ਹਾਂ ਹਾਂ ਕੋਈ ਨਹੀਂ ਦੱਸ ਨਾਲ ਕੋਈ ਨਹੀਂ ਠੀਕ ਐ ਜੀ